ਮੋਹਾਲੀ ਜ਼ਿਲੇ ਵਿੱਚ ਬਜ਼ੁਰਗਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਿ ਉਹ ਉਹਨਾਂ ਨੂੰ ਨੇੜੇ ਤੋਂ ਨੇੜੇ ਸਿਹਤ ਸਹੂਲਤਾਂ ਦੀ ਕਮੀ ਹੈ ਹਸਪਤਾਲ ਜਾਣ ਲਈ ਆਪਣੇ ਬੱਚਿਆਂ 'ਤੇ ਡਿਪੈਂਡ ਰਹਿਣਾ ਪੈਂਦਾ ਹੈ ਅਤੇ ਜਾਣ ਦੇ ਲਈ ਕੋਈ ਨਾ ਕੋਈ ਸਾਧਨ ਉਹਨਾਂ ਨੂੰ ਕਰਨਾ ਪੈਂਦਾ ਹੈ ਅਤੇ ਉੱਥੇ ਜਾ ਕੇ ਵੀ ਉਹਨਾਂ ਨੂੰ ਇੰਨੀਆਂ ਸਹੂਲਤਾਂ ਨਹੀਂ ਹਨ ਕਿ ਉਹਨਾਂ ਦੀ ਨਾਲ ਦੀ ਨਾਲ ਉਹਨਾਂ ਦੀ ਕੇਅਰ ਹੋਵੇ ਬਾਕੀ ਹੋਰ ਕੰਮਾਂ ਵਿੱਚ ਵੀ ਜਿਵੇਂ ਇੱਕ ਥਾਂ ਤੋਂ ਦੂਜੀ ਥਾਂ ਜਾਣਾ ਹੈ ਤਾਂ ਕਿਸੇ ਬੱਸ ਗੱਡੀ ਦੀ ਸਹਾਇਤਾ ਦੇ ਨਾਲ ਜਾਣਾ ਹੈ ਤਾਂ ਉਹਦੇ ਲਈ ਵੀ ਉਹਨਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਵੈਸੇ ਲਗਭਗ ਅੱਜ ਕੱਲ ਦੇ ਬਜ਼ੁਰਗ ਆਪਣੇ ਆਪ ਨੂੰ ਆਪ ਸੰਭਾਲਣ ਦੀ ਕੋਸ਼ਿਸ਼ ਤਾਂ ਕਰਦੇ ਹਨ ਪਰ ਫਿਰ ਵੀ ਉਹਨਾਂ ਨੂੰ ਇੱਕ ਡਿਪੈਂਡ ਰਹਿਣਾ ਪੈਂਦਾ ਹੈ ਇੱਕ ਤਰ੍ਹਾਂ ਨਾਲ ਨਾ